ਅੱਜ ਦੇ ਸਮੇਂ 'ਚ ਵਿਗਿਆਪਨ ਦੇ ਲੋਕ ਜਿਹੜੇ ਤਰੀਕੇ ਵਰਤਦੇ ਨੇ ਪਹੁੰਚਣ ਦੇ ਲਈ ਵੱਧ ਤੋਂ ਵੱਧ ਲੋਕਾਂ ਲਈ ਉਹ ਨਿਊਜ਼ਪੇਪਰ ਤਾਂ ਹੁਣ ਵੈਸੇ ਘੱਟ ਗਿਆ ਵੈਸੇ ਚਲੋ ਜਿੰਨੇ ਪੜ੍ਹਦੇ ਨੇ ਉਹਨਾਂ 'ਚ ਇਸ਼ਤਿਹਾਰ ਪਾ ਦਿੰਦੇ ਨੇ ਟੀ ਵੀ ਹੋ ਗਿਆ ਮੋਬਾਈਲ ਫ਼ੋਨ ਸਭ ਤੋਂ ਵੱਡਾ ਹੋ ਗਿਆ ਉਹਦੇ ਵਿੱਚ ਡਿਜੀਟਲ ਮਾਰਕੀਟਿੰਗ ਜਿਵੇਂ ਸੋਸ਼ਲ ਮੀਡੀਆ ਯੂਸ ਕਰਦੇ ਹਾਂ ਉਹਦੇ ਵਿੱਚ ਇਸ਼ਤਿਹਾਰ ਆ ਜਾਂਦੇ ਨੇ ਐਡਵਰਟੀਜਮੈਂਟ ਆ ਜਾਂਦੀ ਹੈ ਮਸ਼ਹੂਰੀ ਆ ਜਾਂਦੀ ਹੈ ਬਾਕੀ ਰੋਡ ਜਾਂ ਰੋਡ 'ਤੇ ਜਾਂਦੇ ਹੋਏ ਸਾਈਡਾਂ 'ਤੇ ਹੋਰਡਿੰਗਜ਼ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਸਾਈਡਾਂ 'ਤੇ ਇਸ਼ਤਿਹਾਰ ਲੱਗੇ ਹੁੰਦੇ ਨੇ ਬੈਨਰ ਲੱਗੇ ਹੁੰਦੇ ਨੇ ਉਹ ਅੱਜ ਕੱਲ੍ਹ ਬਹੁਤ ਜ਼ਿਆਦਾ ਵਰਤੇ ਜਾਂਦੇ ਨੇ ਅਤੇ ਸਭ ਤੋਂ ਜਿਹੜਾ ਅਲੱਗ ਜਾਂ ਮਤਲਬ ਜਾਂ ਜ਼ਿਆਦਾ ਇੰਟਰਸਟਿੰਗ ਜਾਂ ਜ਼ਿਆਦਾ ਜਿਹਦੇ ਵਿੱਚ ਵਧੀਆ ਲੱਗਦਾ ਹੈ ਕਿ ਵੀ ਹਾਂ ਉਹ ਹੈਗੀ ਆ ਸੋਸ਼ਲ ਮੀਡੀਆ ਮਾਰਕੀਟਿੰਗ ਕਿਉਂਕਿ ਜੋ ਤੁਸੀਂ ਸੋਚਦੇ ਹੋ ਕਈ ਵਾਰ ਜਾਂ ਬੋਲਦੇ ਹੋ ਗੱਲ ਕਰਦੇ ਹੁੰਦੇ ਹੋ ਉਹ ਮਸ਼ਹੂਰੀਆਂ ਤੁਹਾਡੇ ਅੱਗੇ ਆਉਣ ਲੱਗ ਜਾਂਦੀਆਂ ਨੇ ਉਹ ਐਡ ਆ ਚੱਲਣ ਲੱਗ ਜਾਂਦੀ ਹੈ ਜਿਹਦੀ ਤੁਸੀਂ ਸੋ ਗੱਲ ਕਰ ਰਹੇ ਹੁੰਦੇ ਹੋ ਹੈ ਨਾ ਅਤੇ ਅਤੇ ਉਹਨਾਂ ਦੀ ਜਿਹੜੀ ਪ੍ਰੈਜੈਂਟੇਸ਼ਨ ਆ ਦਿਖਾਉਣ ਦਾ ਤਰੀਕਾ ਹੁੰਦਾ ਜਿਹੜਾ ਉਹ ਸਾਰਿਆਂ ਨਾਲੋਂ ਵੱਖਰਾ ਅਤੇ ਇੰਟਰਸਟਿੰਗ ਹੁੰਦਾ ਠੀਕ ਹੈ ਐਨੀਮੇਸ਼ਨ ਹੁੰਦੀ ਹੈ ਕਈ ਵਾਰ ਕਾਰਟੂਨਾਂ ਨਾਲ ਜਾਂ ਆਰਟੀਫਿਸ਼ਲ ਇੰਟੈਲੀਜਸ ਜਿਹੜੀ ਹੈਗੀ ਆ ਉਹਨੂੰ ਹੋਰ ਨਿਖਾਰ ਕੇ ਜਿਹੜੀ ਹੈਗੀ ਹੈ ਮਸ਼ਹੂਰੀ ਨੂੰ ਪ੍ਰਭਾਵਸ਼ਾਲੀ ਬਣਾ ਦਿੰਦੀ ਹੈ